ਮੈਂ ਆਪਣੇ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਨਾਲ ਟੀਚਰ ਟਰਿੱਪ 'ਤੇ ਵੰਡਰਲੈਂਡ ਜੋ ਕਿ ਜਲੰਧਰ ਵਿਖੇ ਹੈ ਉੱਥੇ ਗਈ ਸਾਂ ਉੱਥੇ ਜਾ ਕੇ ਅਸੀਂ ਬਹੁਤ ਹੀ ਆਨੰਦ ਕੀਤਾ ਬੱਚਿਆਂ ਦੇ ਨਾਲ ਮੈਡਮਾਂ ਦੇ ਨਾਲ ਅਤੇ ਆਪਣੇ ਪ੍ਰਿੰਸੀਪਲ ਸਾਹਿਬਾਨ ਦੇ ਨਾਲ ਬਹੁਤ ਹੀ ਥਾਵਾਂ 'ਤੇ ਉੱਥੇ ਫੋਟੋਆਂ ਖਿੱਚੀਆਂ ਤਸਵੀਰਾਂ 'ਚ ਅਸੀਂ ਉੱਥੇ ਸਭ ਤੋਂ ਵਧੀਆ ਦੇਖਣ ਵਾਲਾ ਵੰਡਰਲੈਂਡ ਦੇ ਵਿੱਚ ਇੱਕ ਬਹੁਤ ਹੀ ਵੱਡਾ ਆਲੀਸ਼ਾਨ ਸਵੀਮਿੰਗ ਪੂਲ ਹੈ ਜਿਸ ਵਿੱਚ ਬਹੁਤ ਸਾਰੇ ਲੋਕ ਗਰਮੀਆਂ ਦੇ ਦਿਨਾਂ ਵਿੱਚ ਉਚੇਚੇ ਆ ਕੇ ਉੱਥੇ ਬਹੁਤ ਹੀ ਮਨੋਰੰਜਨ ਕਰਦੇ ਹਨ ਅਸੀਂ ਉੱਥੇ ਆਪਣੇ ਸਟਾਫ ਦੇ ਨਾਲ ਅਤੇ ਵਿਦਿਆਰਥੀਆਂ ਨਾਲ ਬਹੁਤ ਸਾਰੀਆਂ ਤਸਵੀਰਾਂ ਖਿੱਚੀਆਂ ਅਤੇ ਮੈਂ ਚਾਹੁੰਦੀ ਹਾਂ ਕਿ ਕੁਝ ਚੀਜ਼ਾਂ ਹੋਰ ਵੀ ਦੇਖੀਆਂ ਜਾਣ ਜਿਵੇਂ ਕਿ ਆਪਣੇ ਭਾਰਤ ਵਿੱਚ ਦਿੱਲੀ ਵਿੱਚ ਲਾਲ ਕਿਲਾ ਹੈ ਸੰਸਦ ਭਵਨ ਹੈ ਉੱਥੇ ਜਾ ਕੇ ਵੀ ਤਸਵੀਰਾਂ ਖਿੱਚਣੀਆਂ ਚਾਹੁੰਦੀ ਹਾਂ ਅਤੇ ਨਾਲ ਹੀ ਜੰਤਰ ਮੰਤਰ ਅਤੇ ਕੁਤਬ ਮਿਨਾਰ ਵੀ ਵਿਦਿਆਰਥੀਆਂ ਨਾਲ ਜਾ ਕੇ ਤਸਵੀਰਾਂ ਖਿੱਚਣ ਦੇ ਵਿੱਚ ਚਾਹਵਾਨ ਹਾਂ